ਮੈਂ ਸੁਨੀਲ ਕੁਮਾਰ ਮਿਰਜ਼ਾਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਤੁਹਾਨੂੰ ਦੱਸਣਾ ਸੀ ਵੀ ਚਾਹੁੰਦਾ ਹਾਂ ਕਿ ਮੈਂ ਇੱਕ ਦਿਨ ਆਪਣੇ ਦੋਸਤ ਨਾਲ ਅਜਮੇਰ ਸ਼ਰੀਫ ਜੋ ਕਿ ਐਮਪੀ ਵਿੱਚ ਪਿਆ ਹੈ ਜਾਣ ਦਾ ਉੱਥੇ ਆਪਾਂ ਪ੍ਰੋਗਰਾਮ ਬਣਾ ਲਿਆ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ ਅਤੇ ਮੈਂ ਆਪਣੇ ਬੱਚਿਆਂ ਨੂੰ ਵੀ ਆਪਣੇ ਸਾਥ ਆਪਣੇ ਘਰਦਿਆਂ ਨੂੰ ਆਪਣੇ ਨਾਲ ਅਤੇ ਆਪਣੇ ਦੋਸਤ ਦੀ ਫੈਮਲੀ ਦੇ ਨਾਲ ਘੁੰਮਣ ਜਾਣ ਦੀ ਸਲਾਹ ਕੀਤੀ ਤਾਂ ਉਸ ਤੋਂ ਪਹਿਲਾਂ ਮੈਂ ਆਪਣੇ ਜੋ ਵੀ ਰੇਲਵੇ ਇਨਕੁਆਰੀ ਰੇਲਵੇ ਟਿਕਟ ਬਾਰੇ ਜਾਣਕਾਰੀ ਲਈ ਕਿ ਇਹ ਟ੍ਰੇਨ ਕਦੋਂ ਕਦੋਂ ਜਾਂਦੀ ਹੈ ਜੋ ਡਾਇਰੈਕਟ ਅਜਮੇਰ ਸ਼ਰੀਫ ਸਾਨੂੰ ਪਜਾ ਦੇਵੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਗੱਡੀ ਅਜਮੇਰ ਸ਼ਰੀਫ ਇੰਨੀ ਇੰਨੀ ਤਰੀਕ ਨੂੰ ਜਾਂਦੀ ਹੈ ਉਹ ਹਰ ਦਿਨ ਪਠਾਣਕੋਟ ਤੋਂ ਰਾਤ ਨੂੰ ਚਲਦੀ ਹੈ ਫਿਰ ਮੈਂ ਪੁੱਛ ਗਿੱਛ ਕਰਨ ਤੋਂ ਬਾਅਦ ਆਪਾਂ ਉੱਧਰ ਦਾ ਪਲੈਨ ਬਣਾ ਲਿਆ ਜਾਣ ਦਾ ਅਤੇ ਮੈਂ ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਟੈਮ ਇੰਨੇ ਟਾਈਮ 'ਤੇ ਗੱਡੀ ਚਲਣੀ ਹੈ ਤਾਂ ਆਪਾਂ ਸਾਰੇ ਉਹਨਾਂ ਦੀ ਫੈਮਿਲੀ ਦੋਸਤ ਦੀ ਫੈਮਿਲੀ ਅਤੇ ਮੇਰੀ ਫੈਮਿਲੀ ਇਕੱਠੇ ਆਪਾਂ ਗੱਡੀ ਕਰਕੇ ਰੇਲਵੇ ਸਟੇਸ਼ਨ ਪਠਾਨਕੋਟ 'ਤੇ ਪੁਜੇ ਅਤੇ ਉਸ ਤੋਂ ਬਾਅਦ ਆਪਾਂ ਫਿਰ ਅਜਮੇਰ ਸ਼ਰੀਫ ਵਾਲੀ ਗੱਡੀ ਵਿੱਚ ਬੈਠ ਕੇ ਰੇਲ ਗੱਡੀ ਵਿੱਚ ਬੈਠ ਕੇ ਅਤੇ ਆਪਾਂ ਅਜਮੇਰ ਸ਼ਰੀਫ ਨੂੰ ਜਾਣ ਲਈ ਰਵਾਨਾ ਹੋ ਗਏ ਅਤੇ ਸਾਨੂੰ ਟੂਰ ਜਾਣ ਵਿੱਚ ਬਹੁਤ ਮਜ਼ਾ ਆਇਆ